ਫੋਟੋਗ੍ਰਾਫੀ ਕਈ ਚੀਜ਼ਾਂ ਉੱਤੇ ਨਿਰਭਰ ਕਰਦੀ ਹੈ ਜਿਵੇਂ ਕਿ ਜਿਹੜੀ ਚੀਜ਼ ਦੀ ਤੁਸੀਂ ਫੋਟੋ ਖਿੱਚਣਾ ਚਾਹੁੰਦੇ ਹੋ ਉਹ ਕਿੰਨੀ ਦੂਰੀ 'ਤੇ ਹੈ ਅਤੇ ਉੱਥੋਂ ਰੌਸ਼ਨੀ ਕਿਵੇਂ ਦੀ ਕੈਮਰੇ ਵਿੱਚ ਦਾਖਲ ਹੋ ਰਹੀ ਹੈ ਇਹਨਾਂ ਦੋਨਾਂ ਚੀਜ਼ਾਂ ਦੇ ਸੁਮੇਲ ਨਾਲ਼ ਫੋਟੋ ਵਧੀਆ ਖਿੱਚੀ ਜਾਂਦੀ ਹੈ ਅਤੇ ਕਈ ਵਾਰ ਇਵੇਂ ਹੁੰਦਾ ਹੈ ਕੋਈ ਤੇਜ਼ ਦ੍ਰਿਸ਼ ਹੁੰਦਾ ਹੈ ਜਿਸ ਨੂੰ ਅਸੀਂ ਕੈਮਰੇ ਵਿੱਚ ਕੈਦ ਕਰਨਾ ਚਾਹੁੰਦੇ ਹਾਂ ਪਰੰਤੂ ਉਹ ਸਾਡੇ ਕੈਮਰੇ ਦੇ ਅੱਖ ਵਿੱਚ ਨਹੀਂ ਆ ਸਕਦਾ ਇਸ ਲਈ ਉਸ ਵੇਲੇ ਸਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਲਈ ਕੈਮਰੇ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਫੰਕਸ਼ਨ ਜਿਵੇਂ ਕਿ ਫੋਕਸ ਅਪਰਚਰ ਫੋਕਲ ਲੈਂਥ ਵਗੈਰਾ ਵੀ ਹੁੰਦੀ ਹੈ ਅਤੇ ਉਸਦੇ ਨਾਲ਼ ਇਹਨਾਂ ਦਾ ਨਿਪਟਾਰਾ ਆਸਾਨੀ ਨਾਲ਼ ਕੀਤਾ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਕਮਾਲ ਦੀਆਂ ਤਸਵੀਰਾਂ ਖਿੱਚਣਾ ਚਾਹੁੰਦੇ ਹੋ ਤਾਂ ਇਸ ਲਈ ਅਭਿਆਸ ਦੀ ਲੋੜ ਹੁੰਦੀ ਹੈ ਜਿੰਨਾਂ ਅਭਿਆਸ ਤੁਹਾਡਾ ਸਹੀ ਹੋਵੇਗਾ ਉਨੀਆਂ ਹੀ ਤਸਵੀਰਾਂ ਵਧੀਆ ਤਰੀਕੇ ਨਾਲ਼ ਖਿੱਚੀਆਂ ਜਾਣਗੀਆਂ